ਇੱਕ ਬਾਈਕਰ ਵਜੋਂ ਸਾਡੇ ਨਾਲ ਬਹੁਤ ਹੀ ਵੱਡੀਆਂ ਚੁਣੌਤੀਆਂ ਹਨ ਜਿਨ੍ਹਾਂ ਨਾਲ ਸਾਨੂੰ ਬਹੁਤ ਹੀ ਸਾਵਧਾਨੀ ਨਾਲ ਸਾਹਮਣਾ ਕਰਨਾ ਪੈਂਦਾ ਹੈ ਖ਼ਰਾਬ ਟਰੈਫਿਕ ਨਾਲ ਉਹ ਚੱਲਣ ਦੀ ਸ਼ੀਟ ਵਿੱਚ ਹੋ ਸਕਦਾ ਹੈ ਅਤੇ ਸੁਰੱਖਿਆ ਲਈ ਹੋਰ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਹਨ ਖ਼ਰਾਬ ਮੌਸਮ ਵਿੱਚ ਸਾਨੂੰ ਬਹੁਤ ਹੀ ਸੁਰੱਖਿਆ ਨਾਲ ਵਿਸ਼ੇਸ਼ ਧਿਆਨ ਰੱਖਦੇ ਹੋਏ ਸੁਰੱਖਿਆ ਸੁਰੱਖਿਆ ਕਰਦੇ ਹੋਏ ਬਹੁਤ ਹੀ ਤਰੀਕੇ ਨਾਲ ਚੱਲਣਾ ਪੈਂਦਾ ਹੈ ਖਸਤਾ ਹਾਲਤ ਸੜਕਾਂ ਅਤੇ ਤੰਗ ਸੜਕਾਂ ਉੱਤੇ ਉਹ ਬਹੁਤ ਹੀ ਵੱਧ ਗਤੀ ਨਾਲ ਚੱਲਣ ਨਾਲ ਜੋੜ ਜੋੜ ਨਾਲ ਸਾਡੇ ਟਾਇਰ ਫਟ ਜਾਂਦੇ ਹਨ ਅਤੇ ਸਾਨੂੰ ਮੌਤ ਦਾ ਖਤਰਾ ਹੁੰਦਾ ਹੈ ਸਾਨੂੰ ਅੱਗੇ ਵਾਹਨਾਂ ਦੇ ਅੱਗੇ ਤੇਜ਼ ਚੱਲਣ ਨਾਲ ਕਈ ਜਾਨਵਰ ਨਾ ਆ ਵੀ ਆ ਜਾਨਵਰ ਵੀ ਆ ਜਾਂਦੇ ਹਨ ਜਿਸ ਨਾਲ ਸਾਨੂੰ ਬਹੁਤ ਹੀ ਸਾਵਧਾਨੀ ਨਾਲ ਵਧਣਾ ਪੈਂਦਾ ਹੈ ਅਤੇ ਇਲਾਕੇ ਦੇ ਵਿੱਚ ਚੱਲਣ ਦੀ ਬਹੁਤ ਹੀ ਬਹੁਤ ਹੀ ਹੌਲੀ ਤਰੀਕੇ ਨਾਲ ਚੱਲਣਾ ਪੈਂਦਾ ਹੈ ਤਾਂ ਜੋ ਉਸ ਦੇ ਅੱਗੇ ਬੱਚੇ ਨਾ ਆ ਨਾ ਆ ਜਾਣ ਅਤੇ ਉਹਨਾਂ ਦੀ ਮੌਤ ਨਾ ਹੋ ਜਾਏ ਅਸੀਂ ਇਹਦੇ ਨਾਲ ਨਾਲ ਸਾਨੂੰ ਉਹਨਾਂ ਦੇ ਇਲਾਕੇ 'ਚ ਚੱਲਣ ਤੋਂ ਬਚਣ ਲਈ ਉਚਿਤ ਉਪਕਰਨ ਦੀ ਵਰਤਣ ਵੀ ਕਰਨੀ ਪੈਂਦੀ ਹੈ ਸਾਰੀਆਂ ਹੀਰਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਸ ਉਹਨਾਂ ਸਾਰੀਆਂ ਸਥ ਸਥਿਤੀਆਂ ਨੂੰ ਪੂਰੀ ਸੂਚੀ ਤਿਆਰ ਕਰਨ ਦੀ ਜ਼ਰੂਰਤ ਹੈ ਅਤੇ ਤਾਜ਼ਗੀ ਨਾਲ ਵਰਤਣ ਲਈ ਸਿੱਖਿਆ ਜਾਣਾ ਚਾਹੀਦਾ ਹੈ ਜਿਹਦੇ ਕਾਰਨ ਸਾਨੂੰ ਕੋਈ ਖ਼ਤਰਾ ਨਾ ਹੋਵੇ ਅਤੇ ਆਪਾਂ ਆਪਣਾ ਸਫ਼ਰ ਬਹੁਤ ਹੀ ਤਰੀਕੇ ਮੇ ਕਰ ਸਕੀਏ ਜਿਹਦੇ ਕਰਕੇ ਸਾਨੂੰ ਬਹੁਤ ਹੀ ਬਹੁਤ ਹੀ ਦਿੱਕਤ ਆਉਂਦੀ ਹੈ ਅਤੇ ਅੱਗੇ ਚੱਲਣ ਵਿੱਚ ਬੜੀ ਦਿੱਕਤ ਬੜੀ ਪਰੇਸ਼ਾਨੀ ਹੁੰਦੀ ਹੈ